ਸਤਿ ਸ਼੍ਰੀ ਅਕਾਲ ਜੀ ਮੈਂ ਅੱਜ ਤੁਹਾਨੂੰ ਭਾਰਤ ਦੇ ਭੋਜਨ ਬਾਰੇ ਦੱਸਣਾ ਚਾਹੁੰਦੀ ਹਾਂ ਭਾਰਤ ਦਾ ਭੋਜਨ ਬੜਾ ਹੀ ਮਜ਼ੇਦਾਰ ਅਤੇ ਸਵਾਦਿਸ਼ਟ ਅਤੇ ਸਿਹਤਮੰਦ ਹੁੰਦਾ ਹੈ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਭਾਰਤ ਦੇ ਨੌਜਵਾਨ ਬਹੁਤ ਹੀ ਅੱਗੇ ਵੱਧ ਰਹੇ ਹਨ ਇਸਦਾ ਇੱਕੋ ਹੀ ਕਾਰਨ ਹੈ ਕਿਉਂਕਿ ਉਨ੍ਹਾਂ ਦਾ ਖਾਣਾ ਪੀਣਾ ਰਹਿਣਾ ਸਹਿਣਾ ਬੜਾ ਹੀ ਵਧੀਆ ਹੈ ਉਹ ਤੰਦਰੁਸਤੀ ਨਾਲ ਰਹਿੰਦੇ ਹਨ ਵਧੀਆ ਖਾਂਦੇ ਹਨ ਅਤੇ ਅੱਗੇ ਵੱਧ ਰਹੇ ਹਨ ਰੋਜ਼ਾਨਾ ਜੀਵਨ ਵਿੱਚ ਜਿਵੇਂ ਕਿ ਦਾਲ ਚਾਵਲ ਇਹ ਚੀਜ਼ਾਂ ਸਾਰੇ ਭਾਰਤ ਵਿੱਚ ਬਹੁਤ ਜ਼ਿਆਦਾ ਬਣਾਈਆਂ ਜਾਂਦੀਆਂ ਹਨ ਜਿੱਦਾਂ ਕਿ ਭਾਰਤ ਵਿੱਚ ਹਰੇਕ ਪ੍ਰਾਂਤਾਂ ਵਿੱਚ ਹਰੇਕ ਭੋਜਨ ਦਾ ਆਪਣਾ ਆਪਣਾ ਰੋਲ ਹੈ ਸਾਰੇ ਹੀ ਭਾਰਤ ਵਿੱਚ ਹਰੇਕ ਪ੍ਰਾਂਤਾਂ ਵਿੱਚ ਵਧੀਆ ਵਧੀਆ ਭੋਜਨ ਬਣਾਏ ਜਾਂਦੇ ਹਨ ਜੋ ਕਿ ਬੜੇ ਹੀ ਸਵਾਦਿਸ਼ਟ ਹੁੰਦੇ ਹਨ ਜਿੱਦਾਂ ਕਿ ਮੈਂ ਆਪਣੇ ਪੰਜਾਬ ਦੀ ਗੱਲ ਕਰਾਂ ਅੰਮ੍ਰਿਤਸਰ ਦੇ ਵਿੱਚ ਸਰਸੋਂ ਦਾ ਸਾਗ ਮੱਕੀ ਦੀ ਰੋਟੀ ਅਤੇ ਦੇਸੀ ਘਿਓ ਬੜਾ ਹੀ ਪ੍ਰਸਿੱਧ ਹੈ ਅੰਮ੍ਰਿਤਸਰ ਦਾ ਕੁਲਚਾ ਲੋਕ ਦੂਰੋਂ ਦੂਰੋਂ ਇਸ ਨੂੰ ਖਾਣ ਆਉਂਦੇ ਹਨ ਅਤੇ ਪ੍ਰਸਿੱਧ ਮਸਾਲੇ ਜਿੱਦਾਂ ਕਿ ਛੋਟੀ ਇਲਾਇਚੀ ਵੱਡੀ ਇਲਾਇਚੀ ਦਾਲਚੀਨੀ ਇਹ ਮਸਾਲੇ ਬੜੇ ਹੀ ਵਧੀਆ ਮੰਨੇ ਜਾਂਦੇ ਹਨ ਅਤੇ ਭਾਰਤ ਦੇ ਭੋਜਨ ਦਾ ਕੋਈ ਵੀ ਜਵਾਬ ਨਹੀਂ ਹੈ ਭਾਰਤ ਦਾ ਭੋਜਨ ਬੜਾ ਹੀ ਸਵਾਦ ਹੁੰਦਾ ਹੈ ਧੰਨਵਾਦ